ਹਾਂ ਭਾਰਤ ਦੇ ਵਿੱਚ ਨੌਕਰੀ ਦਾ ਬਾਜ਼ਾਰ ਜਿਹੜਾ ਚੱਲ ਰਿਹਾ ਇਸ ਵੇਲੇ ਠੀਕ ਚੱਲ ਰਿਹਾ ਪ੍ਰਾਈਵੇਟ ਵੀ ਹੈ ਸਰਕਾਰੀ ਵੀ ਨੇ ਮੌਜੂਦਾ ਚੁਣੌਤੀਆਂ ਇਹ ਹੈ ਵੀ ਕੰਪਨੀਆਂ ਉਥੇ ਲੱਗ ਜਾਣ ਅਤੇ ਮੌਕੇ ਵੀ ਕਾਫ਼ੀ ਹੈਗੇ ਐਸੀ ਕੋਈ ਗੱਲ ਨਹੀਂ ਆ ਆਪਣੇ ਭਾਰਤ ਦੇ ਵਿੱਚ ਨੌਕਰੀਆਂ ਪ੍ਰਾਈਵੇਟ ਸਰਕਾਰੀ ਅਦਾਰੇ ਬਹੁਤ ਅੱਛੇ ਚੱਲ ਸਕਦੇ ਹੈ ਲੇਕਿਨ ਫਿਰ ਵੀ ਕਈ ਆਪਣੇ ਐਜੂਕੇਸ਼ਨ ਦੇ ਹਿਸਾਬ ਨਾਲ ਤਜਰਬੇ ਦੇ ਹਿਸਾਬ ਨਾਲ ਸੱਜੇ ਖੱਬੇ ਜਾਂਦੇ ਹੈ ਉਹ ਮੁਸ਼ਕਿਲ ਵੀ ਆਉਂਦੀ ਹੈ ਲੇਕਿਨ ਸਾਰੇ ਮਸਲੇ ਹੱਲ ਹੋ ਜਾਂਦੇ ਨੇ ਓਕੇ